ਹਾਂਜੀ ਮੈਂ ਨੌਜਵਾਨ ਮੁੰਡੇ ਨੂੰ ਦੱਸੂੰਗਾ ਜੀ ਵੀ ਸਭ ਤੇ ਪਹਿਲਾਂ ਬੈਂਕ ਮਾ ਜਾਈਦਾ ਜੀ ਵੀ ਉੱਥੇ ਜਾ ਕੇ ਇੱਕ ਵਿਦਡ੍ਰੋਅ ਦਾ ਫਾਰਮ ਆਉਂਦਾ ਜੀ ਵੀ ਇਹਨੂੰ ਭਰੀਦਾ ਇੱਥੇ ਆਪਣਾ ਅਕਾਊਂਟ ਨੰਬਰ ਲਿੱਖ ਇੱਥੇ ਆਪਣਾ ਨਾਮ ਲਿਖ ਅਤੇ ਇੱਥੇ ਅਮਾਉਂਟ ਲਿਖ ਜਿੰਨੇ ਕੱਢਵਾਉਣੇ ਹੈ ਜੀ ਇਸ ਤਰ੍ਹਾਂ ਕਢਵਾ ਕੇ ਉਹ ਸਿੱਧਾ ਕੈਸ਼ੀਅਰ ਕੋਲ ਜਾਊਗਾ ਜੀ ਅਤੇ ਕੈਸ਼ੀਅਰ ਸੈਨ ਕਰਕੇ ਬਕਾਇਦਾ ਬੈਂਕ ਦੀ ਸਟੈਂਪ ਲਾ ਕੇ ਜੀ ਜਿੰਨਾਂ ਕੈਸ਼ ਲਿਖਿਆ ਵਾ ਹੋਊਗਾ ਔਰ ਉਸ ਦੇ ਅਕਾਊਂਟ 'ਚ ਬਣਦਾ ਕੈਸ਼ ਹੋਇਆ ਤਾਂ ਉਹ ਕੱਢ ਕੇ ਦਊਗਾ ਜੀ ਧੰਨਵਾਦ ਜੀ